ਵੈਸੇ ਤਾਂ ਪੰਜਾਬ ਵਿੱਚ ਕੋਈ ਸਪੈਸੇਫਿਕ ਤਿਉਹਾਰ ਜਾਂ ਸਮਾਗਮ ਦੀ ਲੋੜ ਨਹੀਂ ਹੈ ਡਾਂਸ ਕਰਨ ਲਈ ਪਰ ਲੋਕ ਵੈਸੇ ਹੀ ਬਹੁਤ ਖੁਸ਼ ਰਹਿੰਦੇ ਹਨ ਪਰ ਜੇ ਆਪਾਂ ਮਸ਼ਹੂਰ ਸਮਾਗਮ ਜਾਂ ਤਿਉਹਾਰ ਦੀ ਗੱਲ ਕਰੀਏ ਤਾਂ ਬਹੁਤ ਤਰੀਕੇ ਦੇ ਜਿਹੜੇ ਤਿਉਹਾਰ ਇੱਥੇ ਮਨਾਏ ਜਾਂਦੇ ਹਨ ਜਿਸ ਦੇ ਵਿੱਚ ਜਿਹੜਾ ਡਾਂਸ ਹੈ ਉਹ ਬਹੁਤ ਹੀ ਮਹੱਤਵਪੂਰਨ ਭੁਮਿਕਾ ਨਿਭਾਉਂਦੇ ਹਨ ਜਿਵੇਂ ਕਿ ਦੀਵਾਲੀ ਦਾ ਇੱਕ ਇਹੋ ਜਿਹਾ ਤਿਉਹਾਰ ਹੈ ਲੋਕ ਖੁਸ਼ ਰਹਿੰਦੇ ਹਨ ਅਤੇ ਉੱਥੇ ਵੀ ਨੱਚਿਆ ਜਾਂਦਾ ਹੈ ਅਤੇ ਜਨਵਰੀ ਦੇ ਜਾਂ ਫਰਵਰੀ ਦੇ ਮਹੀਨੇ ਵਿੱਚ ਲੋਹੜੀ ਦਾ ਇੱਕ ਇਹੋ ਜਿਹਾ ਤਿਉਹਾਰ ਹੈ ਜਿਹੜਾ ਸਰਦੀਆਂ ਵਿੱਚ ਆਉਂਦਾ ਹੈ ਜਿਹਦੇ ਵਿੱਚ ਲੋਕ ਅੱਗ ਲਗਾਉਂਦੇ ਹਨ ਅਤੇ ਉਹ ਅੱਗ ਦੇ ਚਾਰ ਚੁਫੇਰੇ ਇਕੱਠੇ ਬੈਠ ਕੇ ਡਾਂਸ ਦਾ ਸਮਾਗਮ ਕੀਤਾ ਜਾਂਦਾ ਹੈ